ਸਰ ਮੈਂ ਇੱਕ ਕੰਪਲੇਂਟ ਕਰਨੀ ਸੀ ਮੈਂ ਐਮੇਜ਼ੋਨ ਤੋਂ ਟੀ ਵੀ ਮੰਗਵਾਇਆ ਸੀ ਪਰ ਸਹੀ ਨਹੀਂ ਨਿਕਲਿਆ ਜੀ ਪਹਿਲਾਂ ਤਾਂ ਆਇਆ ਹੀ ਦਸ ਤੋਂ ਪੰਦਰਾਂ ਦਿਨ ਲੇਟ ਡਿਲੀਵਰੀ ਮੇਰੇ ਕੋਲ ਦਸ ਤੋਂ ਪੰਦਰਾਂ ਦਿਨ ਲੇਟ ਹੋਈ ਉੱਪਰੋਂ ਜਦੋਂ ਆਇਆ ਤਾਂ ਉਹਦੀ ਪੈਕਿੰਗ ਵੀ ਫਟੀ ਹੋਈ ਓਪਨ ਪਈ ਸੀ ਸਹੀ ਤਰ੍ਹਾਂ ਪੈਕਿੰਗ ਨਹੀਂ ਹੋਈ ਹੋਈ ਅਤੇ ਇਹ ਵੀ ਚਲੋ ਕੋਈ ਨਹੀਂ ਪਰ ਜਦੋਂ ਮੈਂ ਵੇਖਿਆ ਖੋਲ੍ਹਿਆ ਨਾ ਤਾਂ ਮੈਂ ਹੈਰਾਨ ਰਹਿ ਗਿਆ ਟੀ ਵੀ ਮੈਂ ਸੈਮਸੰਗ ਦਾ ਮੰਗਵਾਇਆ ਸੀ ਅਤੇ ਵਿੱਚੋਂ ਨਿਕਲਿਆ ਐੱਲ ਜੀ ਦਾ ਅਤੇ ਮੇਰੇ ਤਾਂ ਸਾਰੇ ਪੈਸੇ ਖਰਾਬ ਹੋ ਗਏ ਜੀ ਹੁਣ ਤੱਕ ਦੇ ਅਤੇ ਕਿਰਪਾ ਕਰਕੇ ਜਾਂ ਤਾਂ ਟੀ ਵੀ ਬਦਲ ਕੇ ਦਿੱਤਾ ਜਾਵੇ ਮੈਨੂੰ ਮੈਨੂੰ ਸੈਮਸੰਗ ਦਾ ਹੀ ਦਿੱਤਾ ਜਾਵੇ ਅਤੇ ਜਿਹੜਾ ਹੁਣ ਮੇਰੇ ਕੋਲ ਐੱਲ ਜੀ ਦੇ ਵੀ ਹੈ ਉਹ ਵੀ ਨਹੀਂ ਚੱਲ ਰਿਹਾ ਉਹ ਵੀ ਖਰਾਬ ਆ ਜੀ ਸਕਰੀਨ ਨਹੀਂ ਉਹਦੀ ਸਹੀ ਹੈਗੀ ਅਤੇ ਤਾਰ ਵੀ ਵੱਢੀ ਟੁੱਕੀ ਜਿਹੀ ਹੈ ਜੀ ਅਤੇ ਇਸ ਵਾਰ ਧਿਆਨ ਵੀ ਰੱਖਿਆ ਜਾਵੇ ਜਦੋਂ ਮੇਰੇ ਕੋਲ ਡਿਲੀਵਰੀ ਹੋਵੇਗੀ ਮੈਨੂੰ ਇੱਕ ਤਾਂ ਕੋਂਪਨੀ ਅਤੇ ਪੈਕਿੰਗ ਪੈਕਿੰਗ ਵੀ ਸਹੀ ਹੋਵੇ ਕੋਂਪਨੀ ਵੀ ਸਹੀ ਹੋਵੇ ਅਤੇ ਮੈਨੂੰ ਸੈਮਸੰਗ ਦਾ ਹੀ ਆਵੇ ਅਤੇ ਜੇ ਇੱਦਾਂ ਨਹੀਂ ਹੋ ਸਕਦਾ ਵੀ ਨਹੀਂ ਬਦਲਿਆ ਜਾ ਸਕਦਾ ਤਾਂ ਮੇਰੇ ਪੈਸੇ ਰਿਟਰਨ ਕਰ ਦਿੱਤੇ ਜਾਣ ਕਿਰਪਾ ਕਰਕੇ ਬੇਨਤੀ ਓ ਹੈ ਜੀ